ਪੰਜਾਬ ਦੀ ਕਲਾ ਤੇ ਸ਼ਿਲਪਕਾਰੀ ਰਵਾਇਤੀ ਸਮਗਰੀਆਂ ਜਿਹੜੀਆਂ ਕਿ ਹੈਗੀਆਂ ਇਹ ਪੰਜਾਬ ਦੀਆਂ ਮਤਲਬ ਵਿਰਾਸਤ ਵੀ ਅਸੀਂ ਕਹਿ ਸਕਦੇ ਆਂ ਇਹ ਸਾਡੇ ਪੰਜਾਬ ਦੀ ਵਿਰਾਸਤ ਹੈ ਜਿਵੇਂ ਕਿ ਅਸੀਂ ਲਗਾ ਲਈਏ ਕਿ ਫੁਲਕਾਰੀ ਫੁਲਕਾਰੀ ਸਾਡੀ ਜਿਹੜੀ ਪੰਜਾਬ ਦੀ ਇੱਕ ਮਤਲਬ ਸਾਡਾ ਸੱਭਿਆਚਾਰ ਵੀ ਕਹਿ ਸਕਦੇ ਹਾਂ ਤੇ ਸਾਡਾ ਕਿਹਾ ਇੱਕ ਪੰਜਾਬ ਦੀ ਵਿਰਾਸਤ ਵੀ ਹੈ ਫੁਲਕਾਰੀ ਦੇ ਨਾਲ ਨਾਲ ਕਈ ਹੋਰ ਵੀ ਅਜਿਹੀਆਂ ਚੀਜ਼ਾਂ ਹਨ ਜੋ ਕਿ ਸਾਡੇ ਪੰਜਾਬ ਦੀ ਵਿਰਾਸਤ ਹਨ ਤੇ ਸਾਡੀ ਸੱਭਿਆਚਾਰ ਦੀ ਪਹਿਚਾਨ ਹੈ ਜਿੱਦਾਂ ਕਿ ਅਸੀਂ ਹੁਣ ਫੁਲਕਾਰੀ ਨੂੰ ਵੀ ਲੈ ਕੇ ਚਲਦੇ ਆਂ ਪੰਜਾਬ ਦੀ ਕਲਾ ਤੇ ਰੂਪ ਦੇ ਵਿੱਚ ਫੁਲਕਾਰੀ ਇਹ ਪਹਿਲਾਂ ਜਿੱਦਾਂ ਕਿ ਫੁਲਕਾਰੀ ਮਤਲਬ ਪੁਰਾਣੇ ਸਮੇਂ ਤੋਂ ਵੀ ਬਹੁਤ ਮਸ਼ਹੂਰ ਹ ਤੇ ਪੁਰਾਣੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ ਇਹ ਇੱਕ ਪ੍ਰਕਾਰ ਦੀ ਚੁੰਨੀ ਹੁੰਦੀ ਹੈ ਜੋ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਜਮਾਨੇ ਦੇ ਵਿੱਚ ਇਹ ਹੱਥ ਨਾਲ ਕੱਢੀ ਜਾਂਦੀ ਸੀ ਤੇ ਹੁਣ ਇਹ ਜਿਹੜੀ ਫੁਲਕਾਰੀ ਹ ਇਹ ਹੁਣ ਅਸੀਂ ਮਸ਼ੀਨਾਂ ਨਾ ਕੱਢਣ ਲੱਗ ਪਿਆ ਫੁਲਕਾਰੀ ਵਿਆਹਾਂ ਦੇ ਸਮੇਂ ਇੱਕ ਅਜਿਹੀ ਪ੍ਰਕਾਰ ਦੀ ਚੁੰਨੀ ਹੈ ਜੋ ਵਿਆਹਾਂ ਦੇ ਸਮੇਂ ਕੁੜੀਆਂ ਮਤਲਬ ਲੈਂਦੀਆਂ ਹੁੰਦੀਆਂ ਸੀ ਤੇ ਹੁਣ ਵੀ ਇਹ ਲਈ ਜਾਂਦੀ ਹੈ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਵਿਆਹ ਫੁਲਕਾਰੀ ਤੋਂ ਬਿਨਾਂ ਮਤਲਬ ਕਿਆ ਹੈ ਉਹ ਕੰਪਲੀਟ ਨਹੀਂ ਹੁੰਦਾ ਸੀ ਤੇ ਅਜਿਹਾ ਹੀ ਮਤਲਬ ਅੱਜ ਕੱਲ ਵੀ ਹੋ ਰਿਹਾ ਹ ਮਤਲਬ ਹੁਣ ਇਹ ਥੋੜਾ ਜਿਹਾ ਪਿਛਲੇ ਸਮੇਂ ਤੋਂ ਲੈ ਕੇ ਹੁਣ ਵਾਲੇ ਸਮੇਂ ਦੇ ਵਿੱਚ ਥੋੜਾ ਘੱਟ ਗਿਆ ਹੈ ਤੇ ਇਹ ਪੰਜਾਬ ਦੀ ਵਿਰਾਸਤ ਹੈ ਤੇ ਸਾਨੂੰ ਜਿਹੜੀ ਸਾਡੀ ਵਿਰਾਸਤ ਹ ਇਹਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ ਤੇ ਫੁਲਕਾਰੀ ਦੀ ਤਰ੍ਹਾਂ ਹੀ ਜਿਦਾਂ ਕਿ ਹੈਂਡ ਇਮਬਰੋਡਰੀ ਹੋ ਗਈ ਜਿੱਦਾਂ ਕਿ ਆਪਾਂ ਕੋਈ ਵੀ ਚੂੜੀਆਂ ਚੂੜੀਆਂ ਲੈ ਲਓ ਠੀਕ ਹ ਚੂੜੀਆਂ ਤੋਂ ਆਪਾਂ ਜਿਹੜੀ ਮਤਲਬ ਚੀਜ਼ਾਂ ਬਣਾਉਂਦੇ ਆ ਆਪਾਂ ਮਤਲਬ ਟੈਕਸਟਾਈਲ ਕੋਈ ਕੱਪੜਾ ਕੱਪੜੇ ਤੋਂ ਆਪਾਂ ਕੋਈ ਵੀ ਜਿਦਾਂ ਕਿ ਆਪਾਂ ਕੋਈ ਵੀ ਕੱਪੜੇ ਤੋਂ ਜਿੱਦਾਂ ਦਰੀਆਂ ਬਣਾਉਂਦੇ ਆ ਸਾਡੀ ਇਹ ਵੀ ਕਿਹਾ ਪ੍ਰਕਾਰ ਦੀ ਕਿਆ ਹ ਜਿਹੜੀ ਰਵਾਇਤੀ ਸਮਗਰੀ ਹੋ ਗਈ ਹ ਠੀਕ ਹ ਤੇ ਜਿਹੜੇ ਹੱਥਾਂ ਦੇ ਨਾਲ ਅਸੀਂ ਲੱਕੜੀ ਦੇ ਉੱਤੇ ਕੋਈ ਚੀਜ਼ ਬਣਾਉਂਦੇ ਆ ਕੰਧਾਂ ਦੇ ਉੱਤੇ ਕੋਈ ਫੁੱਲ ਬੂਟੀਆਂ ਬਣਾਉਂਦੇ ਆ ਇਹ ਸਾਡੀ ਕਿਆ ਏ ਇੱਕ ਪ੍ਰਕਾਰ ਦੀ ਜਿਹੜੀ ਹੈਗੀ ਆ ਵਿਰਾਸਤ ਹ ਤੇ ਇਹ ਜਿਹੜੀ ਸਮਗਰੀ ਹ ਤੇ ਇਹਦੀਆਂ ਮਤਲਵ ਵਰਤੋਂ ਦੀਆਂ ਤਕਨੀਕਾਂ ਵੀ ਬਹੁਤ ਸਾਰੀਆਂ ਹਨ ਇਹਨਾਂ ਨੂੰ ਮਤਲਬ ਜਿੱਦਾਂ ਕਿ ਆਪਾਂ ਕੰਧਾਂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਕੱਚੇ ਘਰ ਹੁੰਦੇ ਸੀ ਕੰਧਾਂ ਦੇ ਉੱਤੇ ਮਤਲਬ ਚਿੱਤਰਬੂਟੀਆਂ ਬਣਾਏ ਜਾਂਦੇ ਸੀ ਇਸ ਤਰਾਂ ਈ ਮਤਲਬ ਕਿਆ ਹ ਜਿੱਦਾਂ ਕਿ ਹੁਣ ਫੁਲਕਾਰੀ ਸੀ ਫੁਲਕਾਰੀ ਨੂੰ ਪੰਜਾਬ ਦਾ ਜੀਆਈ ਟੈਗ ਮਿਲਿਆ ਹੋਇਆ ਹ ਮਤਲਬ ਇਸ ਤਰਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਮਤਲਬ ਪੰਜਾਬ ਦੀ ਜਿਹੜੀ ਕਲਾ ਹ ਤੇ ਸ਼ਿਲਪਕਾਰੀ ਹ ਇਹ ਮਤਲਬ ਬਹੁਤ ਜਿਆਦਾ ਮਤਲਬ ਇਮਪੋਰਟੈਂਟ ਹ